ਰੋਜ਼ਾਨਾ ਦੇ ਖਾਣ ਵਾਲੇ ਪਕਵਾਨਾਂ ਤੋਂ ਇਲਾਵਾ ਅਸੀਂ ਘਰ ਵਿੱਚ ਹੋਰ ਰਾਜਾਂ ਦੇ ਪਕਵਾਨ ਵੀ ਕਈ ਵਾਰੀ ਬਣਾ ਕੇ ਦੇਖੇ ਹਨ ਇਹਨਾਂ ਵਿੱਚੋਂ ਇੱਕ ਪਕਵਾਨ ਅਜਿਹਾ ਹੈ ਜਿਸ ਨੂੰ ਬਣਾਉਣ ਦੇ ਵਿੱਚ ਰਵੇ ਦੀ ਜਾਂ ਕਹਿ ਲਓ ਸੂਜੀ ਦੀ ਬਹੁਤ ਮਾਤਰਾ ਦੇ ਵਿੱਚ ਵਰਤੋਂ ਹੁੰਦੀ ਹੈ ਸੂਜੀ ਦੇ ਉਸ ਦੇ ਵਿੱਚ ਮਤਲਬ ਇੱਕ ਪਤਲਾ ਜਿਹਾ ਘੋਲ ਸੂਜੀ ਦਾ ਤਿਆਰ ਕਰਕੇ ਉਸ ਵਿੱਚ ਆਪਣੇ ਮਨਪਸੰਦ ਦੀਆਂ ਸਬਜ਼ੀਆਂ ਅਤੇ ਮਸਾਲੇ ਪਾਏ ਜਾਂਦੇ ਹਨ ਫਿਰ ਉਸਨੂੰ ਭਾਫ਼ ਦੁਆਰਾ ਪਕਾ ਕੇ ਅਤੇ ਉਸਦੇ ਛੋਟੇ ਛੋਟੇ ਜਿਹੜੀਆਂ ਹੈਗੀਆਂ ਲੋਈਆਂ ਬਣਾਈਆਂ ਜਾਂਦੀਆਂ ਨੇ ਇਸ ਨੂੰ ਨਾਰੀਅਲ ਦੀ ਚਟਨੀ ਦੇ ਨਾਲ ਬੜੇ ਹੀ ਸਵਾਦ ਨਾਲ ਖਾਧਾ ਜਾਂਦਾ ਹੈ ਇਸ ਤੋਂ ਇਲਾਵਾ ਨਾਰੀਅਲ ਦੀ ਨਾਰੀਅਲ ਨੂੰ ਕਰੱਸ਼ ਕਰਕੇ ਜਾਂ ਕਹਿ ਲਉ ਉਸਨੂੰ ਕੱਦੂਕਸ ਕਰਕੇ ਉਸ ਨੂੰ ਚਾਸ਼ਨੀ ਦੇ ਵਿੱਚ ਪਾ ਕੇ ਖੋ ਵਿੱਚ ਖੋਆ ਮਿਲਾ ਕੇ ਇੱਕ ਬਰਫ਼ੀ ਵੀ ਤਿਆਰ ਕੀਤੀ ਜਾਂਦੀ ਹੈ ਇਹ ਦੋਨੋਂ ਚੀਜ਼ਾਂ ਹੀ ਸਾਡੇ ਘਰ ਦੇ ਵਿੱਚ ਸਾਰੇ ਪਰਿਵਾਰਿਕ ਮ ਮੈਂਬਰਾਂ ਵੱਲੋਂ ਬੜੇ ਹੀ ਚਾਅ ਦੇ ਨਾਲ ਖਾਧੀਆਂ ਜਾਂਦੀਆਂ ਹਨ